ਮੇਰੇ ਦਾਦੀ ਜੀ ਬਹੁਤ ਪੜ੍ਹੇ ਲਿਖੇ ਨਹੀਂ ਸਨ ਪਰ ਉਹਨਾਂ ਨੇ ਸੁਣ ਸੁਣਾ ਕੇ ਕਾਫ਼ੀ ਵਿੱਦਿਆ ਹਾਸਿਲ ਕੀਤੀ ਸੀ ਉਹ ਸਾਨੂੰ ਛੋਟੇ ਹੁੰਦਿਆਂ ਗੁਰੂਆਂ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਪਾਠ ਕਰ ਲਿਆ ਕਰਦੇ ਸਨ ਸਾਨੂੰ ਵੀ ਪਾਠ ਸਿਖਾਉਂਦੇ ਹੁੰਦੇ ਸਨ ਲੇਕਿਨ ਮੇਰੇ ਮਾਤਾ ਪਿਤਾ ਜੀ ਜ਼ਰੂਰ ਪੜ੍ਹੇ ਲਿਖੇ ਸਨ ਮੇਰੇ ਮਾਤਾ ਜੀ ਨੇ ਪੰਜਵੀਂ ਤੱਕ ਪੜ੍ਹਾਈ ਕੀਤੀ ਕਿਉਂਕਿ ਸਕੂਲ ਪੰਜਵੀਂ ਤੱਕ ਸੀ ਪਿੰਡ ਵਿੱਚ ਦੂਸਰੇ ਸਕੂਲ ਦੂਰ ਸਨ ਅਤੇ ਕੁੜੀਆਂ ਨੂੰ ਉਸ ਸਮੇਂ ਦੂਰ ਪੜ੍ਹਨ ਵਾਸਤੇ ਨਹੀਂ ਭੇਜਿਆ ਜਾਂਦਾ ਸੀ ਇਸ ਕਰਕੇ ਮੇਰੇ ਮਾਤਾ ਜੀ ਪੜ੍ਹਨਾ ਚਾਹੁੰਦੇ ਹੋਏ ਵੀ ਪੰਜਵੀਂ ਤੋਂ ਅੱਗੇ ਪੜ੍ਹਾਈ ਜਾਰੀ ਨਾ ਰੱਖ ਸਕੇ ਲੇਕਿਨ ਮੇਰੇ ਪਿਤਾ ਜੀ ਨੇ ਨੌਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਉਹਨਾਂ ਦਾ ਮੈਥ ਅਤੇ ਇੰਗਲਿਸ਼ ਬਹੁਤ ਹਾਈ ਸੀ ਬੜੇ ਇੰਟੈਲੀਜੈਂਟ ਸਨ ਲੇਕਿਨ ਉਹਨਾਂ ਦੇ ਪਿੰਡ ਦੇ ਲੋਕ ਮੇਰੇ ਪਿਤਾ ਜੀ ਕੋਲੋਂ ਅੰਗਰੇਜ਼ੀ ਵਿੱਚ ਸਰਕਾਰੀ ਚਿੱਠੀਆਂ ਲਿਖਵਾਉਣ ਆਇਆ ਕਰਦੇ ਸਨ ਕਾਫ਼ੀ ਉਹਨਾਂ ਦਾ ਨਾਂ ਸੀ ਬਹੁਤ ਇੰਟੈਲੀਜੈਂਟ ਸਨ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੇਰੇ ਮਾਤਾ ਜੀ ਨੂੰ ਇਹ ਦਿੱਕਤ ਆਈ ਕਿ ਉਹ ਦੂਰ ਦੇ ਸਕੂਲ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਘਰ ਦੇ ਕੁੜੀਆਂ ਨੂੰ ਦੂਰ ਨਹੀਂ ਭੇਜਿਆ ਕਰਦੇ ਸਨ ਜੇ ਅਸੀਂ ਵਿੱਦਿਆ ਵਿੱਚ ਸੁਧਾਰ ਕਰਨਾ ਹੈ ਤਾਂ ਫਿਰ ਸਕੂਲ ਨੇੜੇ ਨੇੜੇ ਹੋਣੇ ਚਾਹੀਦੇ ਸਨ ਹੁਣ ਤਾਂ ਸਕੂਲ ਬਹੁਤ ਹਨ ਇੱਕ ਪਿੰਡ ਵਿੱਚ ਹੀ ਦੋ ਦੋ ਤਿੰਨ ਤਿੰਨ ਸਕੂਲ ਹਨ ਕੋਈ ਦਿੱਕਤ ਨਹੀਂ ਹੈ ਸਰਕਾਰੀ ਸਕੂਲ ਵੀ ਬਹੁਤ ਹਨ ਅੰਗਰੇਜ਼ੀ ਸਕੂਲ ਵੀ ਬਹੁਤ ਹਨ ਇਸ ਕਰਕੇ ਜੇ ਹੋਰ ਸੁਧਾਰ ਕਰਨਾ ਹੈ ਤਾਂ ਸਕੂਲਾਂ ਦਾ ਦੀ ਦਿਸ਼ਾ ਸ ਦ੍ਰਿਸ਼ ਸੁਧਾਰਨਾ ਚਾਹੀਦਾ ਹੈ ਉਹਨਾਂ ਫੀਸਾਂ ਘੱਟ ਹੋਣੀਆਂ ਚਾਹੀਦੀਆਂ ਹਨ ਸਕੂਲਾਂ 'ਚ ਅਧਿਆਪਕ ਵਧੀਆ ਹੋਣੇ ਚਾਹੀਦੇ ਹਨ ਤਾਂ ਹੀ ਵਿੱਦਿਆ ਵਿੱਚ ਸੁਧਾਰ ਹੋ ਸਕਦਾ ਹੈ ਧੰਨਵਾਦ